ਹੈਲੋ ਹਾਂਜੀ ਤੁਸੀਂ ਓਲਾ ਟੈਕਸੀ ਸਰਵਿਸ ਸਟੇਸ਼ਨ ਤੋਂ ਬੋਲ ਰਹੇ ਹੋ ਹਾਂਜੀ ਮੈਂ ਇੱਕ ਨਾ ਟੈਕਸੀ ਬੁੱਕ ਕਰਵਾਉਣੀ ਸੀ ਜੀ ਮੈਂ ਇੱਥੇ ਸਨ ਸਿਟੀ ਦੇ ਵਿੱਚ ਖੜ੍ਹੀ ਸੀ ਜੀ ਸਨ ਸਿਟੀ ਸਟੇਸ਼ਨ 'ਤੇ ਅਤੇ ਮੈਂ ਇੱਥੋਂ ਦੀ ਨਾ ਆਈ ਆਈ ਟੀ ਰੋਪੜ ਜਾਣਾ ਸੀ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿੰਨੀ ਜਲਦੀ ਤੋਂ ਜਲਦੀ ਤੁਸੀਂ ਮੇਰੇ ਲਈ ਇੱਕ ਕੈਬ ਬਾਰੇ ਦਾ ਪ੍ਰਬੰਧ ਕਰ ਸਕਦੇ ਹੋ